ਨਿਯਮਤ ਤੌਰ 'ਤੇ ਵਿਦਿਆਰਥੀ ਉਹ ਸਕੂਲ ਨਹੀਂ ਜਾ ਸਕਦੇ ਜਿਨ੍ਹਾਂ ਦੇ ਵਿ ਘਰ ਦੀਆਂ ਮੇਨ ਪ੍ਰੋਬਲਮਾਂ ਸਭ ਤੋਂ ਵੱਡੀ ਮੇਨ ਪ੍ਰੋਬਲਮ ਪੈਸਾ ਜੋ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਜਾਂ ਵਧੀਆ ਸਕੂਲਾਂ ਦੇ ਵਿੱਚ ਪੜ੍ਹਾਉਣਾ ਚਾਹੁੰਦੇ ਨੇ ਪਰ ਉਨ੍ਹਾਂ ਕੋਲ ਪੈਸਾ ਨਹੀਂ ਅਤੇ ਬੱਚੇ ਸਰਕਾਰੀ ਸਕੂਲ ਜਾਂ ਪੰਜਾਬੀ ਮੀਡੀਅਮ ਸਕੂਲ ਨੇ ਉਨ੍ਹਾਂ ਦੇ ਵਿੱਚ ਪੜ੍ਹਨਾ ਪਸੰਦ ਨਹੀਂ ਕਰਦੇ ਅਤੇ ਹੋਰ ਆਵਾਜਾਈ ਦੇ ਸਾਧਨ ਵੀ ਨੇ ਜਿਹੜਾ ਕਿ ਗਰੀਬ ਬੰਦਾ ਜਿਹਦੇ ਕੋਲ ਪੈਸਾ ਨਹੀਂ ਹੈਗਾ ਉਹਨੂੰ ਆਵਾਜਾਈ ਦੀ ਵੀ ਪ੍ਰੋਬਲਮ ਆਉਂਦੀ ਆ ਅਮੀਰ ਨੇ ਤਾਂ ਆਪਣਾ ਵਹੀਕਲ ਜਾਂ ਆਪਣਾ ਸਕੂਟਰ ਮੋਟਰਸਾਈਕਲ ਲੈ ਲੈਣਾ ਗਰੀਬ ਨੇ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਉਸ ਤੋਂ ਬਾਅਦ ਕਿਤਾਬਾਂ ਦਾ ਖਰਚਾ ਗਰੀਬ ਬੰਦੇ ਨੂੰ ਕਿਤਾਬਾਂ ਦਾ ਖਰਚਾ ਚੱਕਣਾ ਬਹੁਤ ਜ਼ਿਆਦੇ ਔਖਾ ਹੋਰ ਬੱਚੇ ਦੀ ਅ ਡਰੈਸ ਅਤੇ ਹੋਰ ਆਪਣੇ ਘਰੇਲੂ ਨਿੱਜੀ ਖਰਚੇ ਵੀ ਬਹੁਤ ਜ਼ਰੂਰੀ ਨੇ ਜਿਨ੍ਹਾਂ ਕਰਕੇ ਕੁਝ ਬੱਚੇ ਨੇ ਜਿਹੜੇ ਆਪਣੇ ਸਕੂਲ ਜਾਣ ਤੋਂ ਜਾਂ ਵਿੱਦਿਆ ਲੈਣ ਤੋਂ ਵਾਂਝੇ ਰਹਿ ਜਾਂਦੇ ਨੇ